ਪੰਜਾਬ ਵਿੱਚ ਰੋਗ ਅਤੇ ਮੌਤ ਦਰ ਦੇ ਮੁੱਖ ਕਾਰਨ ਹਨ ਜਿਹਨਾਂ ਵਿੱਚ ਨਸ਼ਾ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਹੈ ਪੰਜਾਬ ਵਿੱਚ ਅੱਜ ਦੇ ਸਮੇਂ ਵਿੱਚ ਬਹੁਤ ਸਾਰਾ ਨਸ਼ਾ ਵਿਕ ਰਿਹਾ ਹੈ ਜੋ ਕਿ ਬਲੈਕ ਵਿੱਚ ਹੀ ਵਿਕਦਾ ਹੈ ਅਤੇ ਸਾਰੀ ਸਰਕਾਰਾਂ ਵੀ ਇਹਨਾਂ ਵਿੱਚ ਹੀ ਲਗਭਗ ਮਿਲੀਆਂ ਰਹਿੰਦੀਆਂ ਹਨ ਅਤੇ ਕਈ ਲੋਕ ਫੇਮਸ ਹੋਣ ਲਈ ਵੀ ਬੇਵਕੂਫਾਂ ਵਾਲੀ ਹਰਕਤਾਂ ਕਰਦੇ ਹਨ ਜਿਵੇਂ ਨਹਿਰ ਵਿੱਚ ਵੀ ਛਾਲ ਮਾਰ ਦਿੰਦੇ ਹਨ ਪਰ ਇਹੋ ਜਿਹੀਆਂ ਦੁਰਘਟਨਾ ਕਾਰਨ ਉਹਨਾਂ ਦੀ ਥਾਂ ਹੀ ਮੌਤ ਹੋ ਜਾਂਦੀ ਹਨ ਜਿਸ ਕਾਰਨ ਪੰਜਾਬ ਵਿੱਚ ਕਾਫੀ ਸਾਰੀ ਮੌਤਾਂ ਹੋ ਰਹੀਆਂ ਹਨ